ਭੰਗੜਾ ਸਾਡਾ ਲੋਕ ਨਾਚ ਹੈ ਭੰਗੜਾ ਪੁਰਾਣੇ ਸਮਿਆਂ ਤੋਂ ਹੀ ਲੋਕ ਵਧੀਆ ਢੰਗ ਨਾਲ ਮਤਲਬ ਪਾ ਰਹੇ ਹਨ ਇਹ ਭੰਗੜਾ ਇੱਕ ਇੰਜੋਇਮੈਂਟ ਦੇ ਨਾਲ ਨਾਲ ਸਰੀਰ ਲਈ ਵੀ ਬਹੁਤ ਫਾਇਦੇਮੰਦ ਹੈ ਕਿਉਂਕਿ ਜਦੋਂ ਬੰਦਾ ਬੰਦਾ ਭੰਗੜਾ ਪਾਉਂਦਾ ਪੂਰਾ ਖੁਸ਼ ਹੋ ਕੇ ਨੱਚਦਾ ਜਿਸ ਨਾਲ ਸਰੀਰ ਦਾ ਜ਼ੋਰ ਵੀ ਲੱਗਦਾ ਹੈ ਉਹ ਇੱਕ ਤਰ੍ਹਾਂ ਦੀ ਆਪਾਂ ਐਕਸਰਸਾਈਜ਼ ਕਹਿ ਸਕਦੇ ਹਾਂ ਭੰਗੜੇ ਦੇ ਵਜੋਂ ਸਰੀਰ ਦੀ ਲੱਗਦੀ ਹੈ ਬੰਦਾ ਇੱਕ ਦੋ ਤਰ੍ਹਾਂ ਦੇ ਕੰਮ ਹੋ ਜਾਂਦੇ ਭੰਗੜੇ ਨਾਲ ਇੱਕ ਤਾਂ ਇੰਜੋਇਮੈਂਟ ਹੋ ਜਾਂਦਾ ਦੂਜਾ ਸਰੀਰ ਦੀ ਐਕਸਰਸਾਈਜ਼ ਵੀ ਹੋ ਜਾਂਦੀ ਹੈ ਜਿਵੇਂ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਕਿ ਕਈ ਵਾਰ ਆਪਾਂ ਜਿਮ ਲਗਾਉਂਦੇ ਹਾਂ ਜਾਂ ਐਰੋਬਿਕ ਐਕਸਰਸਾਈਜ਼ ਵੈਸੇ ਲਗਾਉਂਦੇ ਹਾਂ ਉਹ ਸਾਨੂੰ ਬੋਰਿੰਗ ਲੱਗਦੀਆਂ ਤਾਂ ਹੀ ਤਾਂ ਅੱਜ ਕੱਲ੍ਹ ਹਰੇਕ ਫਿਟਨੈਸ ਜਿਹੜੇ ਸਟੂਡੀਓ ਆ ਉਹਨਾਂ ਦੇ ਵਿੱਚ ਭੰਗੜੇ ਦੀਆਂ ਐਕਸਟਰਾ ਕਲਾਸਾਂ ਦਿੱਤੀਆਂ ਜਾਂਦੀਆਂ ਨੇ ਇਸ ਲਈ ਭੰਗੜਾ ਇੱਕ ਇੰਜੋਇਮੈਂਟ ਦੇ ਨਾਲ ਨਾਲ ਸਰੀਰ ਲਈ ਵੀ ਬਹੁਤ ਵਧੀਆ ਅੰਗ ਹੈ ਧੰਨਵਾਦ ਜੀ